ਉਹ ਸਾਡੇ ਖੇਤਰ ਦੇ ਸਭ ਤੋਂ ਵੱਧ ਜਿਹੜੇ ਪ੍ਰਸਿੱਧ ਡਾਟਾ ਪਲਾਨ ਹੈਗੇ ਹਾਂ ਜਿਵੇਂ ਜੀਓ ਏਅਰਟੈੱਲ ਬੀ ਐੱਸ ਐੱਨ ਐੱਲ ਆਈਡੀਆ ਅਤੇ ਵਾਈਫਾਈ ਦੇ ਰੂਪ ਵਿੱਚ ਜਿਵੇਂ ਅਸੀਂ ਘਰ ਦੇ ਵਿੱਚ ਕਨੈਕਟ ਯੂਜ ਕਰਦੇ ਹਾਂ ਅਤੇ ਬੀ ਐੱਸ ਐੱਨ ਐੱਲ ਦਾ ਵੀ ਵਧੀਆ ਹੈਗਾ ਹਾਂ ਸੋ ਇਹਦੇ ਨਾਲ ਇਹ ਹੈਗਾ ਕਿ ਸਾਨੂੰ ਮਤਲਬ ਅਨਲਿਮਿਟਡ ਡਾਟਾ ਕੋਲਜ਼ ਵਗੈਰਾ ਜਾਂ ਮੈਸੇਜ ਮਿਲ ਜਾਂਦੇ ਹਾਂ ਸੋ ਅਲੱਗ ਅਲੱਗ ਕੰਪਨੀਆਂ ਦੇ ਅਲੱਗ ਅਲੱਗ ਪਲਾਨ ਨੇ ਅਤੇ ਜਿਹਦੇ ਅਨੁਸਾਰ ਉਹ ਵੱਧ ਤੋਂ ਵੱਧ ਜਿਹੜੇ ਉਪਭੋਗਤਾਵਾਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਹਦੇ ਲਈ ਉਹ ਫ੍ਰੀ ਕੁਛ ਕੋਲਿੰਗ ਫ੍ਰੀ ਮਿੰਟ ਰੱਖਦੇ ਹਾਂ ਜਾਂ ਕੁਛ ਲਿਮਿਟਡ ਐੱਸ ਐੱਮ ਐੱਸ ਨ ਫ੍ਰੀ ਸੇਵਾ ਰੱਖੀ ਜਾਂਦੀ ਹੈ ਸੋ ਸਾਡੇ ਮੇਰੇ ਪਰਿਵਾਰ ਵਿੱਚ ਜ਼ਿਆਦਾ ਸਾਡੇ ਅਸੀਂ ਜਿਹੜੇ ਫੋਨ ਦੇ ਵਿੱਚ ਸਿਮ ਯੂਜ ਕਰਦੇ ਹਾਂ ਅਸੀਂ ਆਜੀਓ ਅਤੇ ਏਅਰਟੈੱਲ ਐਂਡ ਆਈਡੀਆ ਹੈ ਨਾ ਘਰ ਕਨੈਕਟ ਲੱਗਿਆ ਹੋਇਆ ਸਾਡੇ ਅਤੇ ਐਂਡ ਸਰਵਿਸ ਵਧੀਆ ਨੇ ਕਨੈਕਟ ਦੀਆਂ ਬੀ ਕਨੈਕਟ ਦੀਆਂ ਵੀ ਚਾਹੇ ਪ੍ਰਾਈਵੇਟ ਕੰਪਨੀ ਹੈ ਬੀ ਐੱਸ ਐੱਨ ਐੱਲ ਜਿਹੜੀ ਹੈਗੀ ਇੱਕ ਗਵਰਨਮੈਂਟ ਹੈਗੀ ਹੈ ਕੰਪਨੀ ਸੋ ਇਹ ਮਤਲਬ ਸਾਰੀਆਂ ਕੰਪਨੀਆਂ ਇਸ ਤਰ੍ਹਾਂ ਫਾਇਦਾ ਹੀ ਪਹੁੰਚਾਦੀਆਂ ਸਾਨੂੰ ਸਾਰੀਆਂ ਨਾ ਡਾਟਾ ਪਲਾਨ ਦੇ ਵਿੱਚ ਇਹਦੇ ਨਾਲ ਜਾਣੀ ਅਸੀਂ ਵੱਧ ਤੋਂ ਵੱਧ ਆਪਣਾ ਘਰ ਔਫਿਸ ਦਾ ਸਾਰਾ ਕੰਮ ਕਰ ਸਕਦੇ ਹਾਂ